ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੋਬਾਈਲ ਫੀਡ ਰੇਡੀਓ ਅਤੇ ਅਖਬਾਰਾਂ ਦੀ ਸਾਡੇ 'ਚ ਕੀ ਮਹੱਤਤਾ ਹੈ ਮੋਬਾਈਲ ਜੋ ਕਿ ਇੱਕ ਬਹੁਤ ਵਧੀਆ ਸੋਰਸ ਹੈ ਅੱਜ ਕੱਲ੍ਹ ਇਨੀ ਤਰੱਕੀ ਹੋ ਚੁੱਕੀ ਹੈ ਕਿ ਮੋਬਾਇਲ ਦੇ ਉਪਰ ਜੋ ਵੀ ਅੱਜ ਕੱਲ੍ਹ ਨਿਊਜ਼ ਵਗੈਰਾ ਜੋ ਵੀ ਮਤਲਬ ਆ ਰਹੀਆਂ ਨੇ ਕੁਛ ਉਹਦੇ ਵਿੱਚ ਅਫਵਾਹਾਂ ਆਉਂਦੀਆਂ ਹਨ ਕੁਝ ਸਹੀ ਜਾਣਕਾਰੀ ਵੀ ਮਿਲਦੀ ਹੈ ਮੋਬਾਈਲ ਦਾ ਸਾਨੂੰ ਬਹੁਤ ਫਾਇਦਾ ਰੇਡੀਓ ਰੇਡੀਓ ਅੱਜ ਤੋਂ ਪਹਿਲਾਂ ਜਿਹੜੀ ਅੱਛੇ ਮਤਲਬ ਸੀਗੇ ਪਰ ਰੇਡੀਓ ਵੀ ਕਈ ਚੈਨਲ ਅੱਛੇ ਜੋ ਵੀ ਚੱਲ ਰਹੇ ਨੇ ਪ੍ਰਸਾਰਨ ਵਧੀਆ ਮਤਲਬ ਨਿਊਜ਼ ਦਿੰਦੇ ਨੇ ਸਾਫ ਸੁਥਰੀ ਨਿਊਜ਼ ਦਿੰਦੇ ਨੇ ਕਈ ਵਾਰੀ ਕੁਛ ਨਾ ਕੁਛ ਮਤਲਬ ਕਿਤੇ ਨਾ ਕਿਤੇ ਥੋੜ੍ਹਾ ਮੋਟਾ ਨੈਗਟਿਵ ਹੋ ਜਾਂਦਾ ਹੈ ਨਾ ਅਖਬਾਰ ਅੱਛੇ ਅਖਬਾਰ ਆ ਜਿਹੜੇ ਵਧੀਆ ਮਤਲਬ ਲਿਖਦੇ ਨੇ ਵਿਕਾਊ ਨਹੀਂ ਹੈਗੇ ਵਧੀਆ ਅਖਬਾਰ ਨੇ ਉਹ ਮਤਲਬ ਜਿਹੜੇ ਅਖਬਾਰ ਉਹ ਵੀ ਅੱਛੀ ਖਬਰ ਦਿੰਦੇ ਨੇ ਅਖਬਾਰਾਂ ਤੋਂ ਵੀ ਸਾਨੂੰ ਬਹੁਤ ਕੁਝ ਮਤਲਬ ਜਾਣਕਾਰੀ ਮਿਲਦੀ ਹੈ ਮੀਡੀਆ ਨੇ ਤਰੱਕੀ ਕਰਨ ਕਰਕੇ ਮੋਬਾਈਲ ਜਿਹੜਾ ਹੈਗਾ ਮੋਬਾਈਲ ਦਾ ਅੱਛਾ ਮਤਲਬ ਸਾਨੂੰ ਰਿਸਪਾਂਸ ਮਿਲ ਰਿਹਾ ਵੀਡੀਓ ਤੋਂ ਵੀ ਰਿਸਪਾਂਸ ਮਿਲ ਰਿਹਾ ਅਖਬਾਰਾਂ ਤੋਂ ਵੀ ਰਿਸਪਾਂਸ ਮਿਲ ਰਿਹਾ ਪਰ ਜਿਹੜੀ ਕੋਈ ਗਲਤ ਜਾਣਕਾਰੀ ਹੈ ਉਹ ਗਲਤ ਹੀ ਹੈ ਇਸ ਕਰਕੇ ਮੇਰਾ ਲਾਸਟ ਤੁਹਾਡਾ ਧੰਨਵਾਦ